ਮਨੁੱਖ ਹਮੇਸ਼ਾ ਆਪਣੀ ਜੜ੍ਹਾਂ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਜਿਵੇਂ ਕਿ ਮੈਂ ਸਿੱਖ ਧਰਮ ਨਾਲ ਬਿਲੋਂਗ ਕਰਦਾ ਹਾਂ ਠੀਕ ਹੈ ਅਤੇ ਮੈਂ ਸਿੱਖ ਧਰਮ ਨਾਲ ਜੁੜੇ ਰਹਿਣਾ ਚਾਹੁੰਦਾ ਹਾਂ ਜਿਵੇਂ ਅੱਜ ਕੱਲ ਅੱਜ ਕੱਲ ਕਈ ਤਰ੍ਹਾਂ ਦੀਆਂ ਪੱਛਮੀ ਭਾਸ਼ਾਵਾਂ ਪੱਛਮੀ ਤਰ੍ਹਾਂ ਦੇ ਧਰਮ ਆ ਗਏ ਹਨ ਕਿਉਂਕਿ ਲੋਕ ਅਪਣਾਉਂਦੇ ਹਨ ਪਰ ਮੈਂ ਆਪਣੇ ਆਪਣੇ ਹੀ ਧਰਮ ਨਾਲ ਜੁੜੇ ਰਹਿਣਾ ਚਾਹੁੰਦਾ ਹਾਂ ਜਿਵੇਂ ਕਿ ਮੈਂ ਆਪਣੇ ਧਰਮ ਨਾਲ ਜੁੜੀਆਂ ਚੀਜ਼ਾਂ ਜਿਵੇਂ ਕਿ ਕੇਸ ਕੇਸ ਦਾੜ੍ਹੀ ਕਿਰਪਾਨ ਇਹਨਾਂ ਵਰਗੀ ਵਸਤੂਆਂ ਨੂੰ ਅਪਣਾਉਣਾ ਚਾਹੁੰਦਾ ਹਾਂ ਠੀਕ ਹੈ ਪੰਜਾਬ ਵਿੱਚ ਹਮੇਸ਼ਾ ਆਪਣੇ ਹੀ ਧਰਮ ਨਾਲ ਜੁੜੀਆਂ ਚੀਜ਼ਾਂ ਚੀਜ਼ਾਂ ਜਿਵੇਂ ਕਿ ਪੰਜਾਬੀ ਅਜਿਹੀ ਚੀਜ਼ਾਂ ਬੋਲਣੀਆ ਚਾਹੀਦੀਆਂ ਹਨ ਸਾਨੂੰ ਇਸ ਤੋਂ ਇਲਾਵਾ ਹੋਰ ਪੱਛਮੀ ਜਿਹੜੀਆਂ ਭਾਸ਼ਾਵਾਂ ਜਾਂ ਪੱਛਮੀ ਪਹਿਰਾਵੇ ਆ ਉਹਨਾਂ ਦੀ ਦੁਰਵਰਤੋਂ ਕਰਕੇ ਆਪਣੇ ਹੀ ਜਿਹੜੇ ਆਪਣੇ ਸੰਸਥਾ ਆਪਣੇ ਧਰਮ ਨਾਲ ਜੋ ਵੀ ਹੈ ਉਹਨਾਂ ਨੂੰ ਜੁੜੇ ਰਹਿਣਾ ਚਾਹੀਦਾ ਹੈ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਠੀਕ ਆ ਉਹ ਆਪਣੇ ਧਰਮ ਅਤੇ ਆਪਣੇ ਆਪਣੇ ਧਰਮ ਨਾਲ ਜੁੜੀਆਂ ਚੀਜ਼ਾਂ ਦੀ ਰਾਖੀ ਕਰ ਸਕੇ ਉਹਨਾਂ ਨੂੰ ਸੰਭਾਲ ਸਕੇ ਅਤੇ ਉਹਨਾਂ ਨੂੰ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਮਿਲ ਸਕੇ ਠੀਕ ਹੈ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਹਮੇਸ਼ਾ ਕੋਈ ਧਰਮ ਵੱਖਰੇ ਵੱਖਰੇ ਹਨ ਪਰ ਹਮੇਸ਼ਾ ਬੰਦੇ ਨੂੰ ਆਪਣੇ ਮਨੁੱਖਤਾ ਨਾਲ ਆਪਣੇ ਧਰਮ ਨਾਲ ਜੁੜੇ ਰਹਿਣ ਕਾਰਨ ਹੀ ਸਭ ਕੁਝ ਆਪਣੇ ਧਰਮ ਦੇ ਪ੍ਰਤੀ ਪਿਆਰ ਧਰਮ ਪ੍ਰਤੀ ਵਿਸ਼ਵਾਸ ਓ ਰੱਖਣਾ ਚਾਹੀਦਾ ਹੈ